ਇੱਕ ਹਜ਼ਾਰ ਇੱਕ ਸੌ ਪੈਂਤੀ ਦਸ ਹਜ਼ਾਰ ਪੰਜ ਸੌ ਪੱਚੀ ਪੰਦਰਾਂ ਹਜ਼ਾਰ ਚਾਰ ਸੌ ਤੀਹ ਪੈਂਤੀ ਹਜ਼ਾਰ ਪੰਜ ਸੌ ਪੈਂਤੀ ਅੱਸੀ ਹਜ਼ਾਰ ਚਾਰ ਸੌ ਅਠੱਤੀ